ਗਤਕਾ ਪੰਜਾਬ ਵਿੱਚ ਬਹੁਤ ਹੀ ਮਹੱਤਵਪੂਰਨ ਖੇਡ ਹੈ ਅੱਜ ਕੱਲ੍ਹ ਇਸ ਖੇਡ ਨੂੰ ਇੰਟਰਨੈਸ਼ਨਲ ਤੱਕ ਬੱਚਿਆਂ ਦੋਰਾਹਾ ਬੱ ਬੱਚਿਆਂ ਦੇ ਰਾਹੀਂ ਖੇਡਿਆ ਜਾਂਦਾ ਹੈ ਇਹਦੀਆਂ ਅਲੱਗ ਅਲੱਗ ਖੇਡਾਂ ਕਰਵਾਈਆਂ ਜਾਂਦੀਆਂ ਹਨ ਇੰਟਰਨੈਸ਼ਨਲ ਤੱਕ ਬੱਚੇ ਖੇਡਦੇ ਹਨ ਉਹਨਾਂ ਨੂੰ ਮੈਡਲ ਅਤੇ ਪੁਰਸਕਾਰ ਅਤੇ ਸਿੱਖ ਸੱਭਿਆਚਾਰ ਨਾਲ ਵੀ ਜੋੜਿਆ ਜਾਂਦਾ ਹੈ ਬੱਚੇ ਜੋ ਗੱਤਕੇ ਨੂੰ ਦੇਖਦੇ ਨੇ ਪ੍ਰੋਤਸਾਹਿਤ ਹੋ ਕੇ ਬੱਚੇ ਨਵੀਆਂ ਨਵੀਆਂ ਅਕੈਡਮੀਆਂ ਵਿੱਚ ਲੱਗਦੇ ਹਨ ਪੰਜਾਬ ਵਿੱਚ ਬਹੁਤ ਹੀ ਗਤਕੇ ਦੀਆਂ ਅਕੈਡਮੀਆਂ ਹਨ ਜਿਹ 'ਚ ਬੱਚੇ ਗਤਕਾ ਜਾ ਕੇ ਖੇਡਦੇ ਹਨ ਗਤਕਾ ਸਾਨੂੰ ਸਾਡੇ ਪੰਜਾਬੀ ਸੱਭਿਆਚਾਰ ਨਾਲ ਜੋੜਦਾ ਹੈ ਗੁਰਬਾਣੀ ਨਾਲ ਜੋੜਦਾ ਹੈ ਗਤਕੇ ਵਿੱਚ ਕੁਛ ਖੇਡਾਂ ਹੁੰਦੀਆਂ ਹਨ ਜਿਵੇਂ ਫਰੀ ਸੋਟੀ ਫਰਾਈ ਕਿਰਪਾਨ ਫਰਾਈ ਫਾਈਟਾਂ ਹੁੰਦੀਆਂ ਹ ਹਨ ਫਰੀ ਸੋਟੀ ਫਾਈਟ ਕਿਰਪਾਨ ਫਰਾਈ ਚੱਕਰ ਉਂਦੇ ਨੇ ਲੋ ਬੱਚੇ ਬਹੁਤ ਸੋਹਣੇ ਲੱਗਦੇ ਨੇ ਨੀਲੇ ਬਾਣੇ ਪਾ ਕੇ ਦੁਮਾਲੇ ਬੰਨ ਕੇ ਕਮਰ ਕੱਸੇ ਕੱਸ ਕੇ ਬੱਚਿਆਂ ਨੂੰ ਇਹ ਖੇਡ ਕਰਵਾਈ ਜਾਂਦੀ ਹੈ ਇਹ ਖੇਡ ਸਾਡੇ ਦਸਵੇਂ ਪਾਤਸ਼ਾਹ ਜੀ ਨੇ ਸ਼ੁਰੂ ਕੀਤੀ ਸੀ ਇਹ ਉਹਨਾਂ ਨੇ ਜੰਗ ਵਿੱਚ ਆਪਣੇ ਆਪ ਅ ਆਪਣੇ ਬਚਾਅ ਲਈ ਸ਼ੁਰੂ ਕੀਤੀ ਗਈ ਸੀ ਉਹਨਾਂ ਦੁ ਉਹਨਾਂ ਦੁਆਰਾ ਅਤੇ ਉਦੋਂ ਦੀ ਇਹ ਖੇਡ ਚੱਲਦੀ ਆ ਰਹੀ ਹੈ ਹੁਣ ਇਸ ਇਹ ਖੇਡ ਨੂੰ ਪਹਿਲਾਂ ਕੋਈ ਨਹੀਂ ਜਾਣਦਾ ਸੀ ਪਰ ਹੁਣ ਇਹ ਖੇਡ ਨੂੰ ਪੂਰੀ ਇੰਟਰਨੈਸ਼ਨਲ ਤੱਕ ਲੈ ਕੇ ਜਾ ਗੇ ਜਾਇਆ ਗਿਆ ਹੈ ਤਾਂ ਬਹੁਤ ਹੀ ਵਧੀਆ ਤਰੀਕੇ ਨਾਲ ਇਹਨੂੰ ਪ੍ਰਸਤੁਤ ਕੀਤਾ ਗਿਆ ਇੰਟਰਨੈਸ਼ਨਲ ਦੇ ਤੌਰ 'ਤੇ ਬਾਹਰ ਲੋਕਾਂ ਨੂੰ ਬਹੁਤ ਹੀ ਇਹਦਾ